ਹਾਂਜੀ ਸਰ ਹਾਂਜੀ ਸਰ ਮੈਂ ਭਾਰਤ ਗੈਸ ਏਜੰਸੀ ਤੋਂ ਸੁਭਾਸ਼ ਕੁਮਾਰ ਬੋਲ ਰਿਹਾ ਸਰ ਮੈਨੂੰ ਇੱਕ ਮਿੰਟ ਦਿਓ ਮੈਂ ਪੰਦਰਾਂ ਤਰੀਕ ਦੀ ਬੁਕਿੰਗ ਚੈੱਕ ਕਰਦਾ ਸਰ ਤੁਹਾਡੀ ਕਿਸ ਐਡਰੈੱਸ ਅਤੇ ਨਾਮ 'ਤੇ ਬੁਕਿੰਗ ਹੋਈ ਸੀ ਸੋਰੀ ਸਰ ਸਾਡੇ ਕੋਲ ਪੰਦਰਾਂ ਤਰੀਕ ਦੀ ਇਸ ਨਾਂ 'ਤੇ ਕੋਈ ਬੁਕਿੰਗ ਨਹੀਂ ਹੋਈ ਤੁਸੀਂ ਹੁਣ ਕਰਵਾ ਸਕਦੇ ਹੋ ਆਪਣੀ ਬੁਕਿੰਗ ਠੀਕ ਹੈ ਸਰ ਕੱਲ੍ਹ ਸਵੇਰ ਤੱਕ ਨਾ ਤੁਹਾਡਾ ਸਿਲੰਡਰ ਘਰ ਪਹੁੰਚ ਜਾਵੇਗਾ ਠੀਕ ਹੈ ਸਰ ਹਾਂਜੀ